ਪੰਜਾਬੀ ਭਾਸ਼ਾ ਸਾਡੇ ਪੰਜਾਬ ਦੀ ਗੁਰਮੁੱਖ ਭਾਸ਼ਾ ਹੈ ਅਤੇ ਇਸ ਭਾਸ਼ਾ ਦੇ ਭਾਸ਼ਾ ਦੇ ਬੋਲਣ ਜਾਂ ਸੁਣਨ ਨਾਲ ਮਤਲਬ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਗੱਲ ਸਮਝਾਉਣੀ ਜਾਂ ਦੱਸਣੀ ਬਹੁਤ ਹੀ ਛੇਤੀ ਸਮਝ ਲੱਗ ਜਾਂਦੀ ਹੈ ਇਸ ਭਾਸ਼ਾ ਦੀ ਜਿਵੇਂ ਕਿ ਆਪਣੇ ਪੰਜਾਬੀ 'ਚ ਗਾਣੇ ਗਾਣੇ ਆਉਂਦੇ ਹਨ ਟੀ ਵੀ 'ਤੇ ਜਾਂ ਆਪਣੇ ਮੀਡੀਆ ਵਿੱਚ ਜੋ ਵੀ ਪੰਜਾਬੀ ਆਪਣੇ ਮੀਡੀਆ ਦਿੰਦੀ ਹੈ ਖ਼ਬਰਾਂ ਦਿੰਦੀ ਹੈ ਜਿਵੇਂ ਕਿ ਰੇਡੀਓ ਰੇਡੀਓ 'ਤੇ ਵੀ ਖ਼ਬਰਾਂ ਗਾਣੇ ਜਾਂ ਕੋਈ ਵੀ ਤਰ੍ਹਾਂ ਦਾ ਪ੍ਰੋਗਰਾਮ ਹੋ ਗਿਆ ਮਤਲਬ ਪੰਜਾਬੀ ਭਾਸ਼ਾ ਵਿੱਚ ਦਿੱਤਾ ਜਾਂਦਾ ਹੈ ਅਤੇ ਉਹ ਪੰਜਾਬੀ ਬੰਦਾ ਸੁਣ ਕੇ ਅਰਾਮ ਨਾਲ ਸਮਝ ਸਕਦਾ ਹੈ ਅਤੇ ਪੰਜਾਬੀ ਭਾਸ਼ਾ ਪੰਜਾਬੀ ਭਾਸ਼ਾ ਜਿਵੇਂ ਕਿ ਆਪਣੇ ਕਿਸੇ ਨੂੰ ਬਾਹਰ ਵੀ ਕਿਤੇ ਮਤਲਬ ਕਿਸੇ ਹੋਰ ਪੰਜਾਬ ਤੋਂ ਬਾਹਰ ਜਾ ਕੇ ਵੀ ਸੁਣਾਈ ਜਾਵੇ ਅਤੇ ਉਹ ਵੀ ਪਸੰਦ ਕਰਦਾ ਹੈ ਸਾਡੀ ਭਾਸ਼ਾ ਪੰਜਾਅ ਪੰਜਾਬੀ ਭਾਸ਼ਾ ਨੂੰ ਜਿੱਦਾਂ ਕਿ ਆਪਣੇ ਪੰਜਾਬ ਨੂੰ ਸੋਨੇ ਦੀ ਚੀੜੀਆ ਕਿਹਾ ਗਿਆ ਹੈ ਇੱਥੇ ਪੰਜਾਬੀ ਭਾਸ਼ਾ ਪੰਜਾਬੀ ਭਾਸ਼ਾ ਚੱਲਦੀ ਹੈ ਅਤੇ ਪੰਜਾਬੀ ਭਾਸ਼ਾ ਸੁਣ ਕੇ ਹਰ ਕੋਈ ਸਮਝ ਸਕਦਾ ਹੈ